ਹੈਲੋ ਹਾਂਜੀ ਸਰ ਟਰੈਵਲ ਏਜੰਸੀ ਤੋਂ ਬੋਲਦੇ ਹਾਂਜੀ ਸਰ ਮੈਂ ਇੱਕ ਟਰੈਵਲ ਦਾ ਪੈਕੇਜ ਬਾਰੇ ਪਤਾ ਕਰਨਾ ਸੀਗਾ ਹਿੱਲ ਸਟੇਸ਼ਨਸ ਦਾ ਅਸੀਂ ਸਰ ਪੰਜ ਜਣੇ ਸਰ ਪੰਜੋ ਅਡਲਟ ਨੇ ਜੀ ਸਰ ਕਿਸੇ ਹਿਲ ਸਟੇਸ਼ਨ 'ਤੇ ਜੀ ਸਰ ਲੇਹ ਲੱਦਾਖ ਦਾ ਸਰ ਪੈਕੇਜ ਬਾਰੇ ਦੱਸ ਦਿਓ ਓਕੇ ਅਤੇ ਇਹਦੇ ਵਿੱਚ ਹੋਟਲ ਅਤੇ ਫੂਡ ਵਗੈਰਾ ਇਨਕਲੁਡਿਡ ਹੋਊਗਾ ਜੀ ਜੀ ਸਰ ਅਤੇ ਸਰ ਇਸ ਦੇ ਵਿੱਚ ਕੋਈ ਡਿਸਕਾਊਂਟ ਜੀ ਸਰ ਮੈਂ ਸਰ ਫਿਰ ਆਉਂਦਾ ਤੁਹਾਡੇ ਔਫਿਸ ਸ਼ਾਮ ਨੂੰ